ਪੰਜਾਬੀ ਅਤੇ ਗੈਰ ਪੰਜਾਬੀ ਸਮਕਾਲੀ ਭਾਰਤੀ ਲੇਖਕ ਦੀ ਅਗਰ ਮੈਂ ਗੱਲ ਕਰਾਂ ਤਾਂ ਮੈਨੂੰ ਸ਼ਿਵ ਕੁਮਾਰ ਬਟਾਲਵੀ ਬਹੁਤ ਪਸੰਦ ਰਹੇ ਹਨ ਉਹਨਾਂ ਦਾ ਕੰਮ ਮੈਨੂੰ ਸ਼ੁਰੂ ਤੋਂ ਹੀ ਉਹਨਾਂ ਦਾ ਲਿਖਿਆ ਹੋਇਆ ਵਰਡ ਮੈਨੂੰ ਸ਼ੁਰੂ ਤੋਂ ਹੀ ਪ੍ਰਭਾਵਿਤ ਕਰਦੇ ਰਹੇ ਹਨ ਉਹਨਾਂ ਨਾਲ ਜ਼ਿਆਦਾ ਖਿੱਚ ਹੋਣ ਦਾ ਇੱਕ ਕਾਰਨ ਐਵ ਹੈ ਕਿ ਮੇਰਾ ਜੋ ਪਿਛੋਕੜ ਹੈ ਉਹ ਬਟਾਲੇ ਨਾਲ ਜੁੜਿਆ ਹੋਇਆ ਅਤੇ ਸ਼ਿਵ ਵੀ ਜੋ ਸੀਗੇ ਉਹ ਬਟਾਲੇ ਨਾਲ ਹੀ ਸੰਬੰਧ ਰੱਖਦੇ ਸੀਗੇ ਇਹ ਸ਼ੁਰੂ ਤੋਂ ਹੀ ਪ੍ਰੇਰਨਾਦਾਇਕ ਇਸ ਲਈ ਰਿਹਾ ਕਿਉਂਕਿ ਮੇਰੇ ਪਿਤਾ ਜੀ ਨੂੰ ਮੇਰੇ ਤਾਇਆ ਜੀ ਨੂੰ ਸ਼ਿਵ ਕੁਮਾਰ ਬਟਾਲਵੀ ਬਹੁਤ ਪਸੰਦ ਸੀਗੇ ਉਹ ਉਹਨਾਂ ਦੀਆਂ ਰਚਨਾਵਾਂ ਜੋ ਹੈ ਕਵਿਤਾਵਾਂ ਜੋ ਹੈ ਉਹ ਸੁਣਦੇ ਹੀ ਰਹਿੰਦੇ ਸੀ ਅਤੇ ਮੈਂ ਉਹਨਾਂ ਦੀ ਲਿਖਤ ਦੀ ਇਹ ਪ੍ਰਸ਼ੰਸਾ ਕਰਦੀ ਹਾਂ ਕਿ ਉਹਨਾਂ ਦੇ ਲਿਖੇ ਜੋ ਬੋਲ ਸੀਗੇ ਨਾ ਉਹ ਬੋਲ ਹੀ ਬਹੁਤ ਪਿਆਰੇ ਹੁੰਦੇ ਸੀ ਬਹੁਤ ਸਾਰੇ ਪੰਜਾਬੀ ਸਿੰਗਰ ਹੈ ਉਹਨਾਂ ਨੇ ਉਹਨਾਂ ਦੀ ਲਿਖੀਆਂ ਹੋਈਆਂ ਕਵਿਤਾਵਾਂ ਨੂੰ ਆ ਗਾਣੇ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਔਰ ਉਹਨਾਂ ਨੂੰ ਪਿਆਰ ਵੀ ਮਿਲਿਆ ਦਿਲਜੀਤ ਦੁਜਾਂਝ ਦਾ ਗਾਣਾ ਇੱਕ ਕੁੜੀ ਜਿੰਦਾ ਨਾਮ ਮੁਹੱਬਤ ਇਹ ਗਾਣਾ ਵੀ ਸ਼ਿਵ ਕੁਮਾਰ ਦੀ ਹੀ ਲੇਖਕ ਹੈ ਉਹਨਾਂ ਨੇ ਹੀ ਲਿਖਿਆ ਸੀਗਾ ਲੋਕਾਂ ਨੇ ਇਹਨੂੰ ਬਹੁਤ ਪਿਆਰ ਦਿੱਤਾ ਇਸ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਨੇ ਜੋ ਸ਼ਿਵ ਕੁਮਾਰ ਬਟਾਲਵੀ ਦੀਆਂ ਲੋਕਾਂ ਦੇ ਦਿਲਾਂ 'ਚ ਵਸੇ ਹੋਈ ਆ ਮੈਨੂੰ ਨਹੀਂ ਲੱਗਦਾ ਕਿ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਕਦੇ ਇਸ ਦੁਨੀਆਂ ਤੋਂ ਖਤਮ ਹੋ ਸਕਦਾ ਹੈ ਸ਼ਿਵ ਕੁਮਾਰ ਬਟਾਲਵੀ ਦੀ ਜੋ ਪਰਸਨਲ ਜ਼ਿੰਦਗੀ ਹੈ ਉਹ ਵੀ ਮੈਨੂੰ ਬਹੁਤ ਅਟਰੈਕਟ ਕਰਦੀ ਰਹੀ ਹੈ ਕਿ ਕਿਵੇਂ ਕਿਹਾ ਜਾਂਦਾ ਕਿ ਕੁੜੀ ਦੇ ਲਈ ਉਹ ਇੰਨੇ ਜ਼ਿਆਦਾ ਜੋ ਕਵੀ ਬਣਨੇ ਸੀਗੇ ਜੋ ਲਿਖਤ ਸੀ ਉਹਨਾਂ ਦੀਆਂ ਜੋ ਲਿਖਤੀਆਂ ਸੀਗੀਆਂ ਸਾਰੀਆਂ ਉਹਦੇ 'ਤੇ ਹੀ ਸੀਗੀਆਂ ਹਾਲਾਂਕਿ ਇਹਦਾ ਕੋਈ ਪ੍ਰਮਾਣ ਤਾਂ ਨਹੀਂ ਹੈ ਪਰ ਜੋ ਕਹਾਣੀ ਦੱਸੀ ਜਾਂਦੀਆਂ ਹੈ ਉਹ ਸੱਚੀ ਬਹੁਤ ਖੂਬਸੂਰਤ ਹਨ